ਸੱਤਵੀਂ ਕਲਾਸ ਦੇ ਵਿੱਚ ਜਦੋਂ ਮੇਰੇ ਸਰ ਅਤੇ ਅ ਮੇਰੇ ਨਾਲ ਜਿਹੜੇ ਯਾਰ ਮਿੱਤਰ ਸੀ ਅਸੀਂ ਸਕਾਊਟਸ ਐਂਡ ਗਾਈਡ ਦੇ ਵਿੱਚ ਟੂਰ 'ਤੇ ਟਰਿੱਪ ਤੇ ਗਏ ਸਨ ਜਿਹਦੇ ਵਿੱਚ ਅਸੀਂ ਪਹਾੜ ਦੇ ਉੱਤੇ ਚੜ੍ਹਾਈ ਚੜ੍ਹਨੀ ਸੀਗੀ ਅਤੇ ਪਹਾੜ ਬਹੁਤ ਉੱਚਾ ਸੀਗਾ ਅਤੇ ਅਸੀਂ ਉਸ ਵੇਲੇ ਅਸੀਂ ਬਹੁਤ ਭੱਜ ਕੇ ਬੜੀ ਮਿਹਨਤ ਦੇ ਨਾਲ ਇੰਨੇ ਉੱਚੇ ਪਹਾੜ ਦੇ ਉੱਤੇ ਚੜ੍ਹਾਈ ਚੜ੍ਹੀ ਅਤੇ ਮੈਨੂੰ ਸ਼ੁਰੂ ਤੋਂ ਹੀ ਪਹਾੜਾਂ ਤੋਂ ਡਰ ਲੱਗਦਾ ਰਿਹਾ ਹੈ ਕਿਉਂਕਿ ਉਹ ਉੱਚੇ ਹੁੰਦੇ ਹਨ ਅਸੀਂ ਉੱਪਰੋਂ ਤੋਂ ਥੱਲੇ ਦੇਖਦੇ ਹਾਂ ਹੇਠਾਂ ਦੇਖਦੇ ਹਾਂ ਤਾਂ ਬਹੁਤ ਡਰ ਲੱਗਦਾ ਹੈ ਲੇਕਿਨ ਉਸ ਚੜ੍ਹਾਈ ਤੋਂ ਬਾਅਦ ਉਸ ਟਰਿੱਪ ਤੋਂ ਬਾਅਦ ਮੇਰਾ ਜਿਹੜਾ ਪਹਾੜਾਂ ਦਾ ਜਿਹੜਾ ਡਰ ਹੈ ਉਹ ਬਹੁਤ ਦੂਰ ਹੋ ਗਿਆ ਹੈ ਕਿਉਂਕਿ ਜਦੋਂ ਮੈਂ ਪਹਾੜ ਦੇ ਉੱਤੇ ਜਾ ਕੇ ਮੈਂ ਦੇਖਿਆ ਵੀ ਇੰਨੀ ਵਧੀਆ ਸੀਨਰੀ ਜਿ ਜਿਸ ਕਾਰਨ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੇਰਾ ਡਰ ਵੀ ਦੂਰ ਹੋ ਗਿਆ